ਕੁੱਝ ਸਥਾਨਕ ਆਵਾਜਾਈ ਦੀ ਵਿਕਲਪ ਹੈਗੇ ਹੈ ਜਿਵੇਂ ਸਕੂਟਰ ਕਾਰ ਬੱਸਾਂ ਟ੍ਰੇਨ ਵਗੈਰਾ ਇਹ ਇਹ ਜਿਹੜੇ ਸਾਧਨ ਹੈਗੇ ਹੈ ਲੋਕਾਂ ਨੂੰ ਉਹਨਾਂ ਦੀਆਂ ਰੋਜ਼ਾਨਾ ਦੈਨਿਕ ਕਿਰਿਆਵਾਂ ਨੂੰ ਆਸਾਨ ਕਰਦੇ ਹੈ ਜਿਵੇਂ ਕੰਮਾਂ ਕਾਰਾਂ ਲਈ ਇੱਧਰ ਉੱਧਰ ਜਾਣਾ ਪੈਂਦਾ ਜਾਂ ਦੂਰ ਦੁਰਾਡੇ ਜਾਣਾ ਪੈਂਦਾ ਤਾਂ ਇਹ ਮਦਦ ਕਰਦਿਆਂ ਨੇ ਸਾਧਨ ਇਸ ਤੋਂ ਇਲਾਵਾ ਜੇ ਅਸੀਂ ਕਿਤੇ ਘੁੰਮਣ ਫਿਰਨ ਜਾਣਾ ਚਾਹੁੰਦੇ ਹਾਂ ਜਾਂ ਕਿਸੇ ਟੂਰ 'ਤੇ ਜਾਣਾ ਹੈ ਆ ਤਾਂ ਉਹਦੇ ਲਈ ਵੀ ਇਹ ਸਾਡੇ ਇਹ ਸਾਧਨ ਸਾਡੀ ਮਦਦ ਕਰਦੇ ਹੈ ਕਿਸੇ ਰਿਸ਼ਤੇਦਾਰਾਂ ਨੂੰ ਅਸੀਂ ਮਿਲਣ ਰਿਸ਼ਤੇਦਾਰ ਨੂੰ ਮਿਲਣ ਜਾਣਾ ਤਾਂ ਉਹਦੇ ਲਈ ਵੀ ਸਾਨੂੰ ਸਾਧਨਾਂ ਰਾਹੀਂ ਹੀ ਜਾਣਾ ਪੈਂਦਾ ਆ ਅਤੇ ਕੁਛ ਕੁ ਥਾਵਾਂ ਦੀ ਪਰਸਨਲ ਸਾਧਨ ਨਹੀਂ ਪਹੁੰਚਿਆ ਜਾ ਸਕਦਾ ਜਿਵੇਂ ਦੂਰ ਨੇ ਜਾਂ ਹਾਈਟ 'ਤੇ ਨੇ ਉੱਥੇ ਅਸੀਂ ਕੀ ਕਰਦੇ ਹਾਂ ਕਿ ਅਸੀਂ ਕੈਬ ਕਰ ਲਈ ਲੋਕਲ ਬੱਸਿਸ ਹੋ ਗਈਆਂ ਟ੍ਰੇਨਾਂ ਵਗੈਰਾ ਨਾਲ ਵੀ ਅਸੀਂ ਆਸਾਨੀ ਨਾਲ ਇੱਧਰ ਉੱਧਰ ਜਾ ਸਕਦੇ ਹਾਂ ਇਹਨਾਂ ਸਾਧਨਾਂ ਦੇ ਵਿੱਚ ਕੁਛ ਕੁ ਸਾਧਨ ਹੈਗੇ ਆ ਵੀ ਇੰਡੀਵਿਜ਼ੂਅਲੀ ਵਰਤੇ ਜਾ ਸਕਦੇ ਆ ਜਿਵੇਂ ਸਕੂਟਰ ਹੈ ਅਤੇ ਵੱਧ ਤੋਂ ਵੱਧ ਦੋ ਜਣੇ ਟਰੈਵਲ ਕਰ ਸਕਦੇ ਹਾਂ ਕਾਰ ਹੋ ਗਈ ਕਾਰ 'ਤੇ ਪੰਜ ਜਣੇ ਜਾ ਸਕਦੇ ਹਾਂ ਸੋ ਡਿਪੈਂਡ ਕਰਦਾ ਕਿ ਅਸੀਂ ਕਿੰਨੇ ਕੁ ਲੋਕ ਅਸੀਂ ਕਿੱਥੇ ਜਾ ਰਹੇ ਹਾਂ ਜੇ ਤਾਂ ਅਸੀਂ ਕਾਫ਼ੀ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਜਾਣਾ ਤਾਂ ਆਈ ਥਿੰਕ ਉਹਦੇ ਲਈ ਬੱਸਾਂ ਜਾਂ ਟਰੇਨਾਂ ਸਾਡੇ ਲਈ ਬਹੁਤ ਫਾਇਦੇਮੰਦ ਹਨ ਇੱਕ ਤਾਂ ਬੱਸਾਂ ਔਰ ਟਰੇਨਾਂ ਦੇ ਵਿੱਚ ਪਰਸਨਲ ਸਾਧਨਾਂ ਨਾਲੋਂ ਅਸੀਂ ਘੱਟ ਪੈਸੇ 'ਤੇ ਯਾਤਰਾ ਕਰ ਸਕਦੇ ਆਂ ਜਿਵੇਂ ਇਹਨਾਂ ਦਾ ਬੱਸਾਂ ਜਾਂ ਟਰੇਨਾਂ ਦੇ ਵਿੱਚ ਟਿਕਟ ਲੈਣੀ ਆ ਅਤੇ ਜੇ ਆਪਣੀ ਅਸੀਂ ਪਰਸਨਲ ਕਾਰ ਜਾਂ ਸਕੂਟਰ ਲੈ ਕੇ ਜਾਂਦੇ ਹਾਂ ਤਾਂ ਫਿਰ ਉਹਦੇ ਲਈ ਸਾਨੂੰ ਪੈਟਰੋਲ ਵਗੈਰਾ ਪਾਉਣਾ ਪਏਗਾ ਸੋ ਕਈ ਵਾਰੀ ਉਹ ਮਹਿੰਗਾ ਵੀ ਕੰਮ ਪੈਂਦਾ ਹੈ ਅਤੇ ਦੂਜੀ ਗੱਲ ਕਿ ਸਕੂਟਰ 'ਤੇ ਅਸੀਂ ਸਿਰਫ਼ ਅਸੀਂ ਦੋ ਬੰਦੇ ਹੀ ਟਰੈਵਲ ਕਰ ਸਕਦੇ ਹਾਂ ਸੋ ਇਹਨਾਂ ਦੀ ਅਲੱਗ ਅਲੱਗ ਥਾਵਾਂ 'ਤੇ ਆਪਣੇ ਆਪਣੇ ਫਾਇਦੇ ਆ ਜੇ ਸਕੂਟਰ 'ਤੇ ਅਸੀਂ ਨੇੜੇ ਤੇੜੇ ਜਾਣਾ ਹੈ ਦੋ ਬੰਦਿਆਂ ਨੇ ਜਾਣਾ ਤਾਂ ਈਜ਼ੀ ਹੈ ਕਾਰ 'ਤੇ ਅਸੀਂ ਪੰਜ ਬੰਦੇ ਟਰੈਵਲ ਕਰ ਸਕਦੇ ਹਾਂ ਸੋ ਇੱਕ ਇਹਨਾਂ ਦੇ ਨਾਲ ਅਸੀਂ ਸਾਧਨ ਮਤਲਬ ਚੀਜ਼ਾਂ ਇੱਧਰ ਉੱਧਰ ਪਹੁੰਚਾਣੀਆਂ ਜਾਂ ਵਪਾਰੀਆਂ ਨੂੰ ਵੀ ਫਾਇਦਾ ਹੈਗਾ ਕਿ ਆਪਣਾ ਸਮਾਨ ਇੱਧਰ ਉੱਧਰ ਪਹੁੰਚਾਣਾ ਉਹ ਸਾਰਾ ਕੁਛ ਅਸੀਂ ਕਰ ਸਕਦੇ ਹਾਂ ਸੋ ਇਹਨਾਂ ਦੀ ਰੋਜ਼ਾਨਾ ਗਤੀ ਸ਼ ਸ਼ੀਲਤਾ ਜਿਹੜੀ ਹੈਗੀ ਹੈ ਜ਼ਿਲ੍ਹੇ ਦੇ ਵਿੱਚ ਕਿ ਜ਼ਿਲ੍ਹੇ ਅਤੇ ਜ਼ਿਲ੍ਹੇ ਨੂੰ ਤਰੱਕੀ ਵੱਲ ਲੈ ਕੇ ਜਾਂਦੇ ਹਨ ਇਹ ਸਾਧਨ ਅਤੇ ਸੌਖਾ ਹੁੰਦਾ ਆ ਆਵਾਜਾਈ ਦਾ ਸਾਰਾ ਕੁਛ ਕਰਨਾ ਜੋ ਵੀ ਹੈ ਵਪਾਰ ਵਗੈਰਾ ਇਹਨਾਂ ਨਾਲ ਚੱਲਦੇ ਹਨ ਸੋ ਆਈ ਥਿੰਕ ਵਧੀਆ ਚੀਜ਼ਾਂ ਨੇ ਇਹ ਸਾਰੀਆਂ